ਭਾਰਤ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਕਰੋੜਾਂ ਖਾਤੇ ਖੁੱਲ ਚੁੱਕੇ ਹਨ ਇਹਨਾਂ ਖਾਤਿਆਂ ਨੂੰ ਖੋਲ੍ਹਣ ਦਾ ਕੋਈ ਖ਼ਰਚਾ ਨਹੀਂ ਲੱਗਦਾ ਅਤੇ ਇਹ ਆਧਾਰ ਕਾਰਡ ਨਾਲ ਲਿੰਕਡ ਹੁੰਦੇ ਹਨ ਔਰ ਇਸ ਤਰ੍ਹਾਂ ਦੇ ਵਿੱਚ ਬੈਂਕਾਂ ਨੇ ਫਸਿਲਟੀ ਪ੍ਰੋਵਾਈਡ ਕੀਤੀ ਹੈ ਕਿ ਉਹਦੇ ਵਿੱਚ ਉਹਨਾਂ ਦੀ ਐਕਸੀਡੈਂਟਲ ਇਸ਼ੋਰੈਂਸ ਵੀ ਹੁੰਦੀ ਹੈ ਅਤੇ ਗੌਰਮੈਂਟ ਨੇ ਕੋਈ ਉਹਨਾਂ ਨੂੰ ਮ ਆਰਥਿਕ ਜਾਂ ਮਦਦ ਕਰਨੀ ਹੋਵੇ ਤਾਂ ਉਹ ਸਿੱਧਾ ਔਨਲਾਈਨ ਇਹਨਾਂ ਦੇ ਅਕਾਊਂਟ ਦੇ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰ ਸਕਦੇ ਹਨ ਜਿਹਦੇ ਕਰਕੇ ਗੌਰਮੈਂਟ ਨੂੰ ਲੋਕਾਂ ਦੇ ਨਾਲ ਕਨੈਕਟ ਬਣਾਉਣ ਦਾ ਮੌਕਾ ਮਿਲਦਾ ਹੈ ਅਤੇ ਲੋਕਾਂ ਦੀ ਹੈਲਪ ਕਰਨ ਲਈ ਸਰਕਾਰ ਨੂੰ ਬਹੁਤੀ ਮੁਸ਼ਕਿਲ ਨਹੀਂ ਹੁੰਦੀ ਜਿਹਦੇ ਕਰਕੇ ਪਹਿਲਾਂ ਜੋ ਗੋਰਮੈਂਟ ਸਹਾਇਤਾ ਕਰਦੀ ਸੀ ਉਹ ਲੋਕਾਂ ਦੇ ਮਿਡਲ ਮੈਨ ਵਿੱਚੋਂ ਪੈਸਾ ਖਾ ਜਾਂਦੇ ਸਨ ਉਹਨੂੰ ਉਹਦੇ ਵਿੱਚ ਉਹਨਾਂ ਦੀ ਰੋਲ ਬਿਲਕੁਲ ਖਤਮ ਹੋ ਚੁੱਕਾ ਹੈ ਔਰ ਇਹੋ ਜਿਹੀਆਂ ਗੌਰਮੈਂਟ ਲੋਕਾਂ ਦੀ ਸੋਸ਼ਲ ਵੈਲਫੇਅਰ ਸਕੀਮਾਂ ਇੰਟਰੋਡਿਊਸ ਕਰਦੀ ਪਈ ਹੈ ਬੈਂਕਾਂ ਦੇ ਥਰੂ ਔਰ ਇੱਕ ਜਿਹੜੀ ਹੋਰ ਸਕੀਮ ਬੈਂਕਾਂ ਦੇ ਥਰੂ ਇੰਟਰੋਡਿਊਸ ਕੀਤੀ ਹੈ ਉਹ ਅਟਲ ਪੈਨਸ਼ਨ ਯੋਜਨਾ ਹੈ ਜਿਹਦੇ ਵਿੱਚ ਜਿਹੜਾ ਅਠਾਰਾਂ ਸਾਲ ਤੋਂ ਲੈ ਕੇ ਚਾਲੀ ਸਾਲ ਦੀ ਉਮਰ ਤੱਕ ਦੇ ਬੰਦੇ ਆਪਣਾ ਖਾਤਾ ਖੁਲਵਾ ਸਕਦੇ ਹਨ ਜਿਹੜੇ ਇਨਕਮ ਟੈਕਸ ਵਗੈਰਾ ਨਹੀਂ ਭਰਦੇ ਔਰ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੀ ਜੋ ਉਹਨਾਂ ਨੇ ਜਮ੍ਹਾਂ ਕਰਵਾਇਆ ਹੁੰਦਾ ਹੈ ਪੂੰਜੀ ਉਹਦਾ ਟੋਟਲ ਦਾ ਜੋ ਕਾਰਪਸ ਬਣਦਾ ਹੈ ਉਹਦੇ ਮੁਤਾਬਿਕ ਉਹਨਾਂ ਨੂੰ ਪੰਜ ਹਜ਼ਾਰ ਤੱਕ ਪਰ ਮਿਨ ਮੰਨਥ ਪੈਨਸ਼ਨ ਮਿਲ ਸਕਦੀ ਹੈ